ਮੈਨੂੰ ਬਚਪਨ ਤੋਂ ਹੀ ਪੰਛੀ ਦੇਖਣ ਦਾ ਬਹੁਤ ਸ਼ੌਂਕ ਸੀ ਮੈ ਜਦੋਂ ਛੋਟੀ ਹੁੰਦੀ ਸੀ ਤਾਂ ਪਿੰਡ ਵਿੱਚ ਰਹਿੰਦੀ ਹੁੰਦੀ ਸੀ ਅਤੇ ਮੈਂ ਪੰਛੀਆਂ ਨੂੰ ਓਹਲੇ ਹੋ ਕੇ ਵੇਖਿਆ ਕਰਦੀ ਸੀ ਅਤੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਦੇਖਦੀ ਹੁੰਦੀ ਸੀ ਜਦੋਂ ਮੈਂ ਛੋਟੀ ਸੀ ਸਾਡੇ ਲਾਗੇ ਚਾਗੇ ਬਹੁਤ ਹੀ ਸੋਹਣੇ ਸੋਹਣੇ ਪੇੜ ਸਨ ਜਿਸ 'ਤੇ ਬਹੁਤ ਹੀ ਪਿਆਰੇ ਪਿਆਰੇ ਪੰਛੀ ਰਹਿੰਦੇ ਸਨ ਮੈਂ ਉਹਨਾਂ ਨੂੰ ਦੇਖਦੀ ਹੁੰਦੀ ਸੀ ਅਤੇ ਮਹਿਸੂਸ ਕਰਦੀ ਸੀ ਕਿ ਇਹਨਾਂ ਦੇ ਜਿਉਣ ਦਾ ਵੀ ਕੀ ਉਦੇਸ਼ ਹੋਵੇਗਾ ਜਦੋਂ ਮੈਂ ਉਹਨਾਂ ਨੂੰ ਦੇਖਦੀ ਸੀ ਤਾਂ ਮੈਂ ਇਹ ਸੋਚਦੀ ਸੀ ਕਿ ਇਹਨਾਂ ਨੂੰ ਆਜ਼ਾਦੀ ਕਿੰਨੀ ਪਸੰਦ ਹੈ ਜਿਹਦੇ ਵਿੱਚ ਇਹ ਉੱਡ ਵੀ ਸਕਦੇ ਹਨ ਜੋ ਉਹਨਾਂ ਦਾ ਦਿਲ ਕਰਦਾ ਉਹ ਕਰ ਸਕਦੇ ਹਨ ਪਰ ਪੰਛੀ ਦੇਖਣ ਦੇ ਹੋਰ ਵੀ ਬਹੁਤ ਰਿਵਾਇਤੀ ਤਰੀਕੇ ਹਨ ਜਿਹਨਾਂ ਨਾਲ ਅਸੀਂ ਤੁਲਨਾ ਕਰਦੇ ਹਾਂ ਜਿਵੇਂ ਕਿ ਪੰਛੀ ਦੇਖਣਾ ਅਤੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਦੇਖਣਾ ਕਿ ਉਹ ਕੀ ਕਰਨਾ ਚਾਹੁੰਦੇ ਹਨ ਕਿਉਂਕਿ ਪੰਛੀਆਂ ਨੂੰ ਸ਼ੋਰ ਸ਼ਰਾਬਾ ਬਿਲਕੁਲ ਵੀ ਪਸੰਦ ਨਹੀਂ ਹੈ ਉਹਨਾਂ ਨੂੰ ਇੱਕ ਸਕੂਨ ਸ਼ਾਂਤੀ ਦੀ ਜ਼ਿੰਦਗੀ ਚਾਹੀਦੀ ਹੈ